ਪ੍ਰਸਿੱਧ ਮਨੋਰੰਜਨ ਅਤੇ ਗਤੀਵਿਧੀਆਂ ਸਿਆਸੀ ਖੇਡਾਂ ਬਹੁਤ ਸਾਰੀਆਂ ਹਨ ਜਿਵੇਂ ਕਿ ਪੰਜਾਬ ਵਿੱਚ ਬਹੁਤ ਸਾਰੇ ਵਾਟਰ ਪਾਰਕ ਹਨ ਅਤੇ ਬਹੁਤ ਸਾਰੇ ਸਨ ਸਿਟੀਜ਼ ਹਨ ਅਤੇ ਮੈਂ ਆਪਣੇ ਅਨੁਸਾਰ ਦੱਸਦਾ ਹਾਂ ਕਿ ਮੈਂ ਅੱਜ ਕੱਲ੍ਹ ਵਾਟਰ ਪਾਰਕਾਂ 'ਤੇ ਦੋ ਵਾਰੀ ਗਿਆ ਹਾਂ ਅਤੇ ਅਸੀਂ ਦੋ ਤਿੰਨ ਜਾਣੇ ਇਕੱਠੇ ਹੋ ਕੇ ਗਏ ਸੀ ਇਹ ਸਾਡੇ ਤੋਂ ਜ਼ਿਆਦਾ ਦੂਰ ਨਹੀਂ ਸੀ ਅੱਸੀ ਕਿਲੋਮੀਟਰ ਦੇ ਸਫ਼ਰ 'ਤੇ ਹੀ ਸਥਿਤ ਸੀ ਅਸੀਂ ਗੱਡੀ ਵਿੱਚ ਗਏ ਸੀ ਸਿਰਫ਼ ਡੇਢ ਘੰਟਾ ਹੀ ਲੱਗਿਆ ਸੀ ਇਸ ਦੌਰਾਨ ਅਸੀਂ ਉੱਥੇ ਪਹੁੰਚ ਕੇ ਬਹੁਤ ਵਾਟਰ ਗੇਮਾਂ ਖੇਡੀਆਂ ਜੋ ਕਿ ਬਹੁਤ ਔਖੀਆਂ ਲੱਗੀਆਂ ਸਨ ਪਰ ਜਦੋਂ ਅਸੀਂ ਖੇਡੀਆਂ ਤਾਂ ਬਹੁਤ ਸੌਖੀਆਂ ਲੱਗੀਆਂ ਵਾਟਰ ਗਾਈਡਸ ਬਹੁਤ ਵਧੀਆ ਲੱਗਿਆ ਅਤੇ ਬਹੁਤ ਮਜ਼ਾ ਆਇਆ